ਮੇਰੀ ਗਾਇਕੀ ਦੇ ਵਿੱਚ ਭਾਵਨਾਵਾਂ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਦਾਨ ਕਰਦੀਆਂ ਨੇ ਰੋਲ ਰੱਖਦੀਆਂ ਜਿਵੇਂ ਮੈਂ ਭਾਵਨਾਵਾਂ ਤੋਂ ਭਾਵ ਸਿਰਫ ਆਪਣੀਆਂ ਅੰਦਰੂਨੀ ਭਾਵਨਾਵਾਂ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਹਾਦਸੇ ਹੋਏ ਨੇ ਜਿਨ੍ਹਾਂ ਨੂੰ ਮੈਂ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦਾ ਕਿਸੇ ਨੂੰ ਕੁਛ ਕਰ ਨਹੀਂ ਸਕਦਾ ਪਰ ਉਹਨਾਂ ਨੂੰ ਮੈਂ ਗੁਣ ਗੁਣਾ ਸਕਦਾ ਹਾਂ ਗਾ ਸਕਦਾ ਹਾਂ ਜਦੋਂ ਮੈਂ ਗਾਉਂਦਾ ਗਾਇਕੀ ਕਰਦਾ ਤਾਂ ਮੈਂ ਆਪਣੇ ਸਾਰੀਆਂ ਭਾਵਨਾਵਾਂ ਉਹਦੇ ਜ਼ਰੀਏ ਨਿਕਾਲ ਦਿੰਦਾ ਬਾਹਰ ਜਿਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਇਹੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਗਾਇਕੀ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ